ਹੈਲੋ ਹੈਲੋ ਹਾਂਜੀ ਬਾਈ ਸਤਵਿੰਦਰ ਗੱਲ ਕਰਦੇ ਓਂ ਮੈਂ ਨਾ ਬਾਈ ਐਕਚੁਲੀ ਮਹਾਰਾਸ਼ਟਰ ਤੋਂ ਸ਼ਿਫਟ ਹੋਇਆਂ ਉਰੇ ਪੰਜਾਬ 'ਚ ਹੁਣੇ ਹੁਣੇ ਆਪਣੀ ਫੈਮਿਲੀ ਨਾਲ ਅਤੇ ਮੈਂ ਮੈਂ ਇੱਕ ਦੋ ਬੰਦੇ ਦੇ ਤੋਂ ਤੁਹਾਡੇ ਬਾਰੇ ਜਾਣਕਾਰੀ ਲਿੱਤੀ ਹੈ ਵੀ ਤੁਸੀਂ ਸਿੱਖ ਇਤਿਹਾਸ ਬਾਰੇ ਬਹੁਤ ਕੁਝ ਜਾਣਦੇ ਓਂ ਅਤੇ ਮੈਨੂੰ ਦੱਸੋਗੇ ਵੀ ਗੁਰੂਆਂ ਬਾਰੇ ਠੀਕ ਹੈ ਠੀਕ ਹੈ ਬਾਈ

ਠੀਕ ਹੈ ਬਾਈ ਠੀਕ ਹੈ ਹਾਂਜੀ ਹਾਂਜੀ ਬਾਈ ਨਹੀਂ ਬਾਈ ਜਾਣਾ ਤਾਹੀਂ ਤਾਂ ਥੋਤੋਂ ਜਾਣਕਾਰੀ ਪ੍ਰਾਪਤ ਕਰਦੇ ਸੀ ਵੀ ਕੀ ਹਾਂ ਠੀਕ ਆ ਬਾਈ ਹਾਂਜੀ ਬਾਈ ਮਹਾਰਾਸ਼ਟਰ ਤੋਂ

ਬਾਈ ਮਹੀਨਾ ਕੁ ਹੋਇਆ ਹਜੇ ਤਾਂ ਕਰਕੇ ਮੰਗਦੇ ਸੀ ਜਾਣਕਾਰੀ ਓਕੇ ਬਾਈ ਥੈਂਕ ਯੂ ਬਹੁਤ ਠੀਕ ਹੈ ਬਾਈ ਓਕੇ ਬਾਈ ਓਕੇ ਜੀ ਓਕੇ